ਆਧੁਨਿਕ ਯੁੱਗ ਵਿੱਚ ਹੋਈਆਂ ਵਿਗਿਆਨੀ ਖੋਜਾਂ ਤੋਂ ਬਾਅਦ ਕਈ ਲੋਕਾਂ ਦਾ ਮੰਨਣਾ ਸੀ ਕਿ ਹੁਣ ਪਰਮਾਤਮਾ ਵਿੱਚ ਲੋਕਾਂ ਦਾ ਵਿਸ਼ਵਾਸ ਖਤਮ ਹੋ ਜਾਵੇਗਾ ਪਰ ਅੱਜ ਵਿਗਿਆਨ ਖੁਦ ਗੁਰੂ ਸਾਹਿਬਾਂ ਦੇ ਸਿਧਾਂਤ ਅੱਗੇ ਝੁਕਦਾ ਦਿਸਦਾ ਹੈ ਜਾਂ ਗੁਰਬਾਣੀ ਵਿਗਿਆਨੀਆਂ ਦੀ ਪੱਥ ਪਾਰਦਰਸ਼ਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਗੁਰਬਾਣੀ ਦੇ ਕੁਝ ਹਵਾਲੇ ਅਰਬਦ ਨਰਬਦ ਤੰਦੂਕਧਾਰਾ ਜਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਵਿੱਚ ਲੱਖ ਆਗਾਸਾ ਆਗਾਸ ਲੱਖ ਪਾਤਾਲਾ ਪਾਤਾਲ ਅਨੁਸਾਰ ਵਿਗਿਆਨੀਆਂ ਦਾ ਬ੍ਰਹਿਮੰਡ 'ਤੇ ਗ੍ਰਹਿ ਦੀ ਖੋਜ ਵੱਲ ਰੁਝਾਨ ਵੱਧ ਗਿਆ ਹੈ ਵੱਖ ਵੱਖ ਦੇਸ਼ਾਂ ਦੇ ਵਿਗਿਆਨੀਆਂ ਨੂੰ ਪਤਾ ਲੱਗ ਗਿਆ ਹੈ ਇਸ ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ ਵਿੱਚ ਜੀਵਨ ਸੰਭਵ ਹੈ ਉਹਨਾਂ ਵਿਗਿਆਨੀਆਂ ਵੱਲੋਂ ਵੱਖ ਵੱਖ ਕਿਸਮ ਦੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਗ੍ਰਹਿ ਤੱਕ ਪਹੁੰਚ ਕਰਨੀ ਸੰਭਵ ਹੋ ਗਈ ਹੈ ਇਸ ਲਈ ਮੁੱਖ ਉਦਾਹਰਨ ਮੰਗਲ ਗ੍ਰਹਿ ਹੈ ਜਿੱਥੇ ਇਨਸਾਨੀ ਜੀਵਨ ਸੰਭਵ ਹੈ ਧਰਤੀ ਵਿਚਲੇ ਜੀਵਨ ਵਰਗਾ ਜਲਵਾਯੂ ਪੌਣ ਪਾਣੀ ਮੌਜੂਦ ਹੋਣ ਕਰਕੇ ਉੱਥੇ ਮਨੁੱਖੀ ਵਸੇਵਾ ਕਰਨਾ ਸੌਖਾ ਹੈ ਅਤੇ ਜਲਦੀ ਹੀ ਵਿਗਿਆਨੀਆਂ ਵੱਲੋਂ ਦਸ ਲੱਖ ਲੋਕਾਂ ਦਾ ਸ਼ਹਿਰ ਵਸਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ